ਹਾਂ ਮੈਂ ਆਪਣੀ ਪਹਿਲੀ ਲਿਖਤ ਦੇ ਪਿੱਛੇ ਦੀ ਕਹਾਣੀ ਸਾਂਝੀ ਕਰਨਾ ਚਾਹੁੰਦਾ ਹਾਂ ਮੇਰੇ ਕਹਾਣੀ ਪਹਿਲੀ ਕਹਾਣੀ ਇਹ ਹੈ ਕਿ ਜਦੋਂ ਮੈਂ ਗਾਣਾ ਲਿਖਣ ਦਾ ਸ਼ੌਕੀਨ ਸੀ ਮੈਨੂੰ ਅਕਸਰ ਹੀ ਥੋੜ੍ਹਾ ਮੋਟਾ ਲਿਖਣਾ ਆਉਂਦਾ ਸੀ ਜਦੋਂ ਮੈਂ ਗਾਣੇ ਲਿਖਣ ਲੱਗਿਆ ਤਾਂ ਮੈਨੂੰ ਸਭ ਤੋਂ ਪਹਿਲਾਂ ਮੈਂ ਕਿਸੇ ਇਹ ਇਨਸਾਨ ਨੂੰ ਗਾਣੇ ਲਿਖਦੇ ਦੇਖਿਆ ਪਹਿਲਾਂ ਮੈਨੂੰ ਗਾਣੇ ਲਿਖਣੇ ਨਹੀਂ ਆਉਂਦੇ ਸਨ ਜਦੋਂ ਮੈਂ ਉਸ ਨੂੰ ਦੇਖਿਆ ਉਸ ਨੇ ਮੈਨੂੰ ਗਾਣੇ ਲਿਖਣ ਦਾ ਸਟਾਈਲ ਦੱਸਿਆ ਮੈਂ ਗਾਣਾ ਇੱਕ ਲਿਖਿਆ ਜੋ ਕਿ ਬਹੁਤ ਵਧੀਆ ਗਾਣਾ ਸੀ ਮੈਂ ਆਪਣੇ ਯਾਰਾਂ ਦੋਸਤਾਂ 'ਚ ਉਸ ਗਾਣੇ ਨੂੰ ਸੁਣਾਇਆ ਉਹ ਗਾਣੇ ਤੋਂ ਬਾਅਦ ਮੈਂ ਸਤਿੰਦਰ ਸਰਤਾਜ ਬਹੁਤ ਜ਼ਿਆਦਾ ਸੁਣਦਾ ਸੀ ਉਸ ਤੋਂ ਬਹੁਤ ਕੁਝ ਸਿੱਖਿਆ ਇਸ ਤਰ੍ਹਾਂ ਗਾਣੇ ਲਿਖਦੇ ਲਿਖਦੇ ਬਹੁਤ ਜ਼ਿਆਦਾ ਮੈਂ ਗਾਣੇ ਲਿਖ ਚੁੱਕੇ ਸੀ ਪਰ ਅੱਜ ਤਾਈਂ ਮੈਂ ਉਸਨੂੰ ਕਿਤੇ ਪਬਲਿਸ਼ ਨਹੀਂ ਕੀਤਾ ਗਾਣੇ ਹਮੇਸ਼ਾ ਹੀ ਸਾਡੀ ਰੂਹ ਨੂੰ ਖੁਸ਼ ਕਰਦੇ ਹਨ ਗਾਣਿਆਂ ਪਿੱਛੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹਨ ਗਾਣੇ ਸੁਣਣਾ ਆਮ ਸਾਡੇ ਸੇ ਸਾਡੇ ਮਨ ਨੂੰ ਠੀਕ ਕਰਦਾ ਹੈ ਗਾਣੇ ਨਾਲ ਸਾਡਾ ਡਿਪਰੈਸ਼ਰ ਲਹਿ ਜਾਂਦਾ ਹੈ ਗਾਣਾ ਬਹੁਤ ਵਧੀਆ ਚੀਜ਼ ਹੈ ਗਾਣੇ ਤੋਂ ਬਾਅਦ ਅਸੀਂ ਸਾਨੂੰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕਹਾਣੀ ਸਭ ਤੋਂ ਪਹਿਲਾਂ ਇਹ ਹੀ ਸੀ ਕਿ ਮੈਂ ਕਿਸੇ ਨੂੰ ਲਿਖਦਾ ਦੇਖਿਆ ਸੀ ਗਾਣੇ ਤੋਂ ਬਾਅਦ ਮੈਂ ਇਸ ਨੂੰ ਜਦੋਂ ਪੂਰਾ ਕਰਨ ਤੋਂ ਬਾਅਦ ਮੈਂ ਜਦੋਂ ਪੂਰੇ ਗਾਣੇ ਲਿਖੇ ਤਾਂ ਇਸ ਮੈਨੂੰ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੋਇਆ ਗਾਣਾ ਲਿਖਤ ਬਹੁਤ ਸਾਨੂੰ ਖੁਸ਼ੀ ਮਿਲੀ ਇਸ ਤੋਂ ਬਾਅਦ ਅਸੀਂ ਬਹੁਤ ਗਾਣੇ ਲਿਖੇ